ਹੈਲੋ ਸਤਿ ਸ਼੍ਰੀ ਅਕਾਲ ਦੀ ਦੀਦੀ ਤੁਸੀਂ ਹਰਪ੍ਰੀਤ ਕੌਰ ਬੋਲਦੇ ਪਏ ਜੇ ਦੀਦੀ ਮੈਂ ਨਾ ਸੰਦੀਪ ਕੌਰ ਬੋਲਦੀ ਪਈ ਹਾਂ ਅਤੇ ਮੈਂ ਨਾ ਦਸਵੀਂ ਪਾਸ ਕਰ ਲਈ ਆ ਅਤੇ ਮੇਰੇ ਨਾ ਕੀ ਫੀਸ ਦੀ ਪ੍ਰੋਬਲਮ ਆ ਰਹੀ ਆ ਮੈਂ ਨਾ ਹਾਇਰ ਐਜੂਕੇਸ਼ਨ ਲੈਣਾ ਚਾਹੁੰਦੀ ਹਾਂ ਅਤੇ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਕੋਲੇਜ ਜਾਂਦੇ ਜੇ ਤਾਂ ਤੁਸੀਂ ਆਪਣੇ ਕੋਲੇਜ ਦੇ ਵਿੱਚ ਮੈਨੂੰ ਕੁਛ ਪਤਾ ਕਰਕੇ ਦੱਸ ਦਓਗੇ ਕਿ ਕੋਈ ਸਕੋਲਰਸ਼ਿਪ ਵਗੈਰਾ ਚੱਲਦੀ ਹੋਵੇ ਤੁਹਾਡੇ ਕੋਲੇਜ ਵਿੱਚ ਕਿਉਂਕਿ ਮੇਰੇ ਮੰਮਾ ਪਾਪਾ ਫੀਸ ਨਹੀਂ ਦੇ ਸਕਦੇ ਤਾਂ ਫਿਰ ਇਸ ਕਰਕੇ ਮੈਂ ਅੱਗੋਂ ਹੋਰ ਪੜ੍ਹਨਾ ਚਾਹੁੰਦੀ ਹਾਂ ਤੇ ਮੇਰੀ ਸ਼ਡਿਊਲ ਕਾਸਟ ਆ ਅਤੇ ਤੁਸੀਂ ਇੰਨਾ ਕੁ ਥੋੜ੍ਹਾ ਪਤਾ ਕਰਕੇ ਦੱਸਿਓ ਮੈਨੂੰ ਹਾਂਜੀ ਹਾਂਜੀ

ਹਾਂਜੀ ਠੀਕ ਹੈ ਜ਼ਰੂਰ ਮੈਨੂੰ ਦੱਸ ਦਿਓ ਜੇ ਠੀਕ ਹੈ ਓਕੇ ਮਿਹਰਬਾਨੀ ਤੁਹਾਡੀ